ਮੇਰੀ ਹੁਣ ਤੱਕ ਦੀ ਸਭ ਤੋਂ ਸੁੰਦਰ ਯਾਤਰਾ ਅੰਮ੍ਰਿਤਸਰ ਦੀ ਯਾਤਰਾ ਹੈ ਜੋ ਸ ਅਸੀਂ ਆਪਣੇ ਸਕੂਲ ਵਾਲਿਆਂ ਦੇ ਨਾਲ ਗਏ ਸੀਗੇ ਸਾਡੀ ਕਲਾਸ ਗਈ ਸੀਗੀ ਅਤੇ ਅਸੀਂ ਉੱਥੇ ਸੇਵਾ ਵੀ ਕੀਤੀ ਅਤੇ ਸ਼ਾਮ ਨੂੰ ਅਸੀਂ ਬਾਜ਼ਾਰ ਵੀ ਘੁੰਮੇ ਸੁਬਾ ਸੁਬਾ ਜਾ ਕੇ ਸਭ ਤੋਂ ਪਹਿਲਾਂ ਅਸੀਂ ਨੇ ਮੱਥਾ ਟੇਕਿਆ ਅਤੇ ਉਸ ਤੋਂ ਬਾਅਦ ਆਪਣਾ ਲੰਗਰ ਛੱਕ ਕੇ ਉਸ ਤੋਂ ਬਾਅਦ ਅਸੀਂ ਗੁਰਦੁਆਰਾ ਸਾਹਿਬ ਸੇਵਾ ਕੀਤੀ ਜਲ ਵਰਤਾਉਣ ਦੀ ਜੋ ਸਾਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਉਸ ਤੋਂ ਬਾਅਦ ਅਸੀਂ ਆਪਣਾ ਰੂਮਸ ਦੇ ਵਿੱਚ ਆ ਕੇ ਅ ਰੈਡੀ ਹੋ ਕੇ ਦੁਬਾਰਾ ਅਸੀਂ ਸ਼ਾਮ ਨੂੰ ਬਾਜ਼ਾਰ ਘੁੰਮੇ ਬਹੁਤ ਜ਼ਿਆਦਾ ਮਜ਼ਾ ਕੀਤਾ ਅਸੀਂ ਉੱਥੇ ਵੱਖ ਵੱਖ ਚੀਜ਼ਾਂ ਵੇਖੀਆਂ ਜੋ ਸਾਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਉੱਥੋਂ ਦਾ ਮਾਹੌਲ ਬਹੁਤ ਜ਼ਿਆਦਾ ਵਧੀਆ ਸੀ ਅਸੀਂ ਸ਼ਾਮ ਨੂੰ ਦੁਬਾਰਾ ਫਿਰ ਗੁਰਦੁਆਰਾ ਸਾਹਿਬ ਗਏ ਪਾਠ ਗੁਰਬਾਣੀ ਸੁਣੀ ਜੋ ਬਹੁਤ ਜ਼ਿਆਦਾ ਵਧੀਆ ਲੱਗਿਆ ਸਾਨੂੰ ਸਭ ਨੂੰ ਬਹੁਤ ਜ਼ਿਆਦਾ ਸਕੂਨ ਮਿਲਿਆ ਜੋ ਇਹ ਯਾਤਰਾ ਮੇਰੇ ਲਈ ਸਭ ਤੋਂ ਵੱਧ ਸੁੰਦਰ ਯਾਤਰਾ ਰਹੀ